ਹੈਲੋ ਹਾਂਜੀ ਫਲਿੱਪਕਾਰਟ ਤੋਂ ਜੀ ਹਾਂਜੀ ਸਰ ਜਿਹੜੀਆਂ ਪਿਛਲੇ ਹਫ਼ਤੇ ਮੈਂ ਤੁਹਾਡੇ ਕੋਲੋਂ ਈ ਬੁਕਸ ਜਿਹੜੀਆਂ ਔਰਡਰ ਕੀਤੀਆਂ ਸੀਗੀਆਂ ਉਹ ਮੈਨੂੰ ਮਿਲ ਗਈਆਂ ਸੀਗੀਆਂ ਪਰ ਉਹਨਾਂ ਦੀ ਸਰ ਪ੍ਰੋਬਲਮ ਸੀਗੀ ਇੱਕ ਵੀ ਉਹ ਜਿਹੜੀਆਂ ਬੁਕਸ ਸੀਗੀਆਂ ਉਹਦੀ ਛਪਾਈ ਆ ਜਿਹੜੀ ਉਹ ਢੰਗ ਨਾਲ ਨਹੀਂ ਹੋਈ ਹੋਈ ਅਤੇ ਹੈਡਿੰਗ ਵੀ ਉਸਦੇ ਮੈਨੂੰ ਕੋਈ ਵਧੀਆ ਨਹੀਂ ਲੱਗੇ ਹੈਗੇ ਅਤੇ ਜਿਹੜੇ ਪ੍ਰੋਡਕਟ ਮੈਂ ਮੰਗਵਾਇਆ ਸੀਗਾ ਉਹ ਮੈਨੂੰ ਮਟੀਰੀਅਲ ਉਸ ਕਿਤਾਬਾਂ ਦੇ ਵਿੱਚੋਂ ਨਹੀਂ ਮਿਲਿਆ ਹੈਗਾ ਸਰ ਉਹ ਵੀ ਤੁਹਾਡਾ ਜਿਹੜਾ ਸਾਰਾ ਗਲਤ ਸੀਗਾ ਜੀ ਸੋਰੀ ਸਰ ਮੇਰੀਆਂ ਜਿਹੜੀਆਂ ਬੁਕਸ ਆ ਇਹ ਵਾਪਸ ਕਰ ਦਿੱਤੀਆਂ ਜਾਣ ਜੀ ਧੰਨ